ਹੈਲੋ ਦਲਜੀਤ ਬੋਲਦੇ ਹੋ ਦਲਜੀਤ ਕੌਰ ਕਿਵੇਂ ਹੋ ਮੈਨੂੰ ਤੁਹਾਡਾ ਨੰਬਰ ਸੈਕਟਰੀ ਤੋਂ ਮਿਲਿਆ ਮੈਂ ਉਹਨਾਂ ਜਿਹਦਾ ਤੂੰ ਘਰ ਲਿੱਤਾ ਸੀ ਨਾ ਉਹਨਾਂ ਨੇ ਤੁਹਾਡਾ ਨੰਬਰ ਦਿੱਤਾ ਹੈਗਾ ਅਤੇ ਉਹਨਾਂ ਨੇ ਮੈਂ ਨਵੀਂ ਆਈ ਹਾਂ ਫਰੀਦਕੋਟ ਦੇ ਵਿੱਚ ਥੋੜ੍ਹਾ ਟਾਈਮ ਹੋਇਆ ਮੈਨੂੰ ਹਾਂਜੀ ਹਾਂਜੀ ਉਹਨਾਂ ਨੇ ਹੀ ਦਿੱਤਾ ਹਾਂਜੀ ਮੈਂ ਨਵੀਂ ਆਈ ਹਾਂ ਅਤੇ ਮੈਨੂੰ ਨਾ ਕਹਿੰਦੇ ਵੀ ਅ ਤੁਸੀਂ ਤੁਹਾਨੂੰ ਵੀ ਉਹਨਾਂ ਨੇ ਹੀ ਦਵਾਇਆ ਹੋਵੇਗਾ ਘਰ ਤੁਹਾਨੂੰ ਬਹੁਤ ਸਾਲ ਹੋ ਗਏ ਰਹਿੰਦੇ ਨੂੰ ਇੱਥੇ ਅਤੇ ਉਹ ਮੈਨੂੰ ਉਹਨਾਂ ਦੱਸਿਆ ਸੀ ਕਹਿੰਦੇ ਉਹਨਾਂ ਨੂੰ ਸਾਰੀ ਜਾਣਕਾਰੀ ਹੈ ਬਾਜ਼ਾਰ ਬਾਰੇ ਤੇ ਸਾਨੂੰ ਤਾਂ ਹਾਲੇ ਪੰਦਰਾਂ ਵੀਹ ਦਿਨ ਹੀ ਹੋਏ ਇੱਥੇ ਆਏ ਨੂੰ ਹਾਂਜੀ ਅਤੇ ਫਿਰ ਮੈਂ ਨਾ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਹਾਂਜੀ ਮੈਂ ਤਾਂ ਇਹ ਹੀ ਪੁੱਛਣਾ ਸੀਗਾ ਕਿ ਵੀ ਨਾ ਅਸੀਂ ਡੇਲੀ ਤਾਜ਼ੀ ਸਬਜ਼ੀ ਕੈਮੀਕਲ ਵਾਲੀ ਕੋਈ ਚੀਜ਼ ਨਹੀਂ ਖਾ ਸਕਦੇ ਬੱਚਿਆਂ ਨੂੰ ਇੰਨਫੈਕਸ਼ਨ ਹੋ ਜਾਂਦੀ ਮੈਨੂੰ ਵੀ ਅਤੇ ਉਹਦੇ ਕਰਕੇ ਵੀ ਮੈਂ ਪੁੱਛਣਾ ਸੀਗਾ ਵੀ ਅਸੀਂ ਵੈਸੇ ਤਾਂ ਬਾਜ਼ਾਰ ਦਾ ਖਾਂਦੇ ਨਹੀਂ ਕੁਛ ਵੈਜੀਟੇਬਲ ਵਗੈਰਾ ਪੁੱਛਣੀਆ ਸੀਗੀਆ ਕਿਉਂ ਪਿੰਡ 'ਚ ਤਾਂ ਸਾਡੇ ਆਪਣੀਆਂ ਸੀਗੀਆਂ ਲੱਗੀਆਂ ਘਰ ਅਤੇ ਇੱਥੇ ਸ਼ਹਿਰ 'ਚ ਹੁਣ ਲਾ ਨਹੀਂ ਸਕਦੇ ਜਗ੍ਹਾ ਹੈ ਨਹੀਂ ਇੰਨੀ ਤਾਂ ਅਸੀਂ ਪੁੱਛਣਾ ਸੀ ਵੀ ਫਰੈਸ਼ ਕਿੱਥੋਂ ਵੀ ਤਾਜ਼ੀਆਂ ਕਿੱਥੋਂ ਮਿਲਣਗੀਆਂ ਸਬਜ਼ੀਆਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਨਹੀਂ ਹਾਂਜੀ ਗਈ ਸੀ ਇੱਕ ਵਾਰ ਨਵੇਂ ਨਵੇਂ ਆਏ ਸੀ ਨਾ ਉਦੋਂ ਜਿਹੇ ਗਏ ਸੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਹਾਂਜੀ ਅੱਛਾ ਜੀ ਫਿਰ ਤਾਂ ਬਹੁਤ ਵਧੀਆ ਹਾਂਜੀ ਉਹਦੇ ਨਾਲ ਮਹਿੰਗੀ ਤਾਂ ਬਾਜ਼ਾਰੋ ਖਾਵਾਂਗੇ ਕੈਮੀਕਲ ਇਹ ਜੋ ਦਵਾਈ ਦੇ ਵੀ ਲਾਵਾਂਗੇ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਾਹਮਣੇ ਮਿਲ ਜ ਰੇਹੜੀਆਂ ਲੱਗ ਜਾਂਦੀਆ ਸਾਰਾ ਸਮਾਨ ਹੀ ਸਾਰੀ ਸਬਜ਼ੀ ਹੁਣ ਜਿਵੇਂ ਮੌਸਮ ਦੇ ਅਨੁਸਾਰ ਸਾਰੀ ਸਬਜ਼ੀ ਰੱਖਦੇ ਹੋਣਗੇ ਵੀ ਸਰਦੀ ਦੇ ਹਿਸਾਬ ਨਾਲ ਸਰਦੀ ਗਰਮੀ ਦੇ ਹਿਸਾਬ ਨਾਲ ਗਰਮੀ ਦੀ ਵੀ ਸਬਜ਼ੀ ਹੁੰਦੀ ਆ ਹਾਂਜੀ ਅੱਛਾ ਜੀ ਚਲੋ ਮੈਂ ਦੇਖਦੀ ਫਿਰ ਮੈਂ ਇਹਨਾਂ ਨੂੰ

ਅੱਛਾ ਜੀ ਹਾਂਜੀ ਚਲੋ ਫਿਰ ਤਾਂ ਵਧੀਆ ਫਰੂਟ ਅਤੇ ਸਾਰੇ ਅਤੇ ਸਬਜ਼ੀਆਂ ਇਕੱਠੀਆਂ ਹੀ ਲਿਆਇਆ ਕਰਾਂਗੇ ਉੱਥੋਂ ਮੈਂ ਕਿਹਾ ਵੀ ਮੈਂ ਪੁੱਛਾਂ ਉਹ ਕਹਿੰਦੇ ਵੀ ਉਹਨਾਂ ਨੂੰ ਪਤਾ

ਹਾਂਜੀ ਫਰਿੱਜਾਂ 'ਚ ਰੱਖਣ ਬ ਗਲਤ ਹੋ ਜਾਂਦਾ ਉਹ ਹੀ ਫਿਰ ਬੇਹੀ ਹੋ ਜਾਂਦੀ ਹੈ ਨਾ ਹਾਂਜੀ ਹਾਂਜੀ ਹਾਂਜੀ ਨਹੀਂ ਨਹੀਂ ਉਹ ਹੀ ਆ ਕਿ ਜਦੋਂ ਆਪਾਂ ਗੇੜਾ ਤਾਂ ਮੈਂ ਵੱਜਦੇ ਜਾ ਸ਼ਹਿਰ 'ਚ ਤਾਂ ਵਾਧੂ ਓ ਗੇੜੇ ਲੱਗ ਜਾਂਦੇ ਆ ਚਲੋ ਫਿਰ ਮੈਂ ਦੱਸਦੀ ਇਹਨਾਂ ਨੂੰ ਸਵੇਰੇ ਅਸੀਂ ਲਿਆਵਾਂਗੇ ਹਾਂਜੀ ਜੇ ਮੈਨੂੰ ਨਾ ਵੀ ਪਤਾ ਲੱਗਿਆ ਮੈਂ ਤੁਹਾਨੂੰ ਦੁਬਾਰਾ ਫੋਨ ਕਰੂੰਗੀ ਵੈਸੇ ਤਾਂ ਮੈਨੂੰ ਸਮਝ ਆ ਗਈ ਕਿੱਥੇ ਜੇ ਮੈਨੂੰ ਨਾ ਵੀ ਮਿਲਿਆ ਫਿਰ ਮੈਂ ਤੁਹਾਨੂੰ ਫੋਨ ਕਰਕੇ ਪੁੱਛ ਲੂੰਗੀ ਇੱਕ ਵਾਰ ਠੀਕ ਆ ਭੈਣ ਜੀ ਠੀਕ ਹੈ ਭੈਣ ਜੀ ਠੀਕ ਹੈ ਠੀਕ ਹੈ ਸਤਿ ਸ਼੍ਰੀ ਅਕਾਲ